ਅਸੀਂ ਭਾਰਤੀ ਮੀਡੀਆ ਬਾਰੇ ਬਹੁਤ ਹੀ ਵਧੀਆ ਸੋਚਦੇ ਹਾਂ ਅੱਜ ਕੱਲ ਦੇ ਯੁੱਗ ਵਿੱਚ ਜੇ ਮੀਡੀਆ ਨਾ ਹੁੰਦੀ ਤਾਂ ਸਾਨੂੰ ਕੁਝ ਵੀ ਦੇਸ਼ ਵਿਦੇਸ਼ ਦਾ ਪਤਾ ਨਾ ਚੱਲਦਾ ਅਸੀਂ ਪੰਜਾਬ ਵਿੱਚ ਵੀ ਬੈਠੇ ਹੋਈਏ ਤਾਂ ਸਾਨੂੰ ਪਤਾ ਚੱ ਖਬਰਾਂ ਦੇ ਰਾਹੀਂ ਪਤਾ ਚੱਲ ਜਾਂਦਾ ਹੈ ਕਿ ਪਾਕਿਸਤਾਨ ਵਿੱਚ ਕੀ ਹੋ ਰਿਹਾ ਹੈ ਜਾਂ ਅਮੈਰੀਕਾ ਵਿੱਚ ਕੀ ਹੋ ਰਿਹਾ ਹੈ ਅੱਜ ਕੱਲ ਦੀਆਂ ਖਬਰਾਂ ਕਈ ਤਰ੍ਹਾਂ ਦੀਆਂ ਖਬਰਾਂ ਹੁੰਦੀਆਂ ਹਨ ਜਿਵੇਂ ਕਿ ਮਨੋਰੰਜਨ ਦੀਆਂ ਖਬਰਾਂ ਸਾਹਿਤ ਦੀਆਂ ਖਬਰਾਂ ਬੋਲੀਵੁੱਡ ਦੀਆਂ ਖਬਰਾਂ ਜੋ ਵੀ ਖਬਰ ਹੋਵੇ ਉਹ ਸਾਨੂੰ ਟੀ ਵੀ ਦੇ ਮਾਧਿਅਮ ਦੇ ਰਾਹੀਂ ਪਤਾ ਚੱਲ ਜਾਂਦੀਆਂ ਹਨ ਅਤੇ ਖਬਰਾਂ ਬਿਲਕੁਲ ਵੀ ਢੁੱਕਵੀਆਂ ਹੁੰਦੀਆਂ ਹਨ ਅਤੇ ਇੱਕਦਮ ਸਹੀ ਤੱਥ ਦਿਖਾਉਂਦੀਆਂ ਹਨ ਖਬਰਾਂ ਦੇ ਰਾਹੀਂ ਹੀ ਪਤਾ ਚੱਲ ਜਾਂਦਾ ਹੈ ਕਿ ਇਹ ਸੱਚ ਹੈ ਜਾਂ ਝੂਠ ਸਾਡੀ ਭਾਰਤੀ ਮੀਡੀਆ ਹਰ ਇੱਕ ਦੁਨੀਆ ਦੇ ਅੰਤ ਕੋਨੇ ਤੱਕ ਜਾਂਦੀ ਹੈ ਅਤੇ ਮੀਡੀਆ ਹੀ ਸਾਨੂੰ ਸੱਚ ਦਿਖਾਉਂਦੀ ਹੈ ਅਸੀਂ ਮਸ਼ਹੂਰ ਅਖ਼ਬਾਰ ਇੱਕ ਦੈਨਿਕ ਜਾਗਰਣ ਅਤੇ ਅਜੀਤ ਅਤੇ ਪੰਜਾਬ ਕੇਸਰੀ ਸਾਡੇ ਪਰਿਵਾਰ ਵਿੱਚ ਸਾਰੇ ਪੜ੍ਹਦੇ ਹਨ ਅਤੇ ਜੋ ਨਿਊਜ਼ ਚੈਨਲ ਹੈ ਜਿਵੇਂ ਕਿ ਆਜ ਤੱਕ ਜੀ ਨਿਊਜ ਇੰਡੀਆ ਟੀ ਵੀ ਅਤੇ ਹੋਰ ਵੀ ਕਈ ਸਾਰੇ ਨਿਊਜ ਚੈਨਲ ਹਨ ਜੋ ਕਿ ਅਸੀਂ ਵੇਖਦੇ ਹਾਂ ਭਾਰਤੀ ਮੀਡੀਆ ਇੱਕ ਐਸੀ ਜ਼ਰੀਆ ਹੈ ਜਿਸ ਦੇ ਰਾਹੀਂ ਅਸੀਂ ਇਹ ਸੋਚਦੇ ਹਾਂ ਕਿ ਮੀਡੀਆ ਸਾਡੇ ਸਾਡੇ ਸਾਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰ ਰਹੀ ਹੈ